ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕਿੱਦਾਂ ਦੀ ਕਾਰ ਚਾਹੀਦੀ ਹੈ ਤੁਹਾਨੂੰ ਮਰੂਤੀ ਕਾਰ ਦਾ ਤਾਂ ਯਾਰ ਬਹੁਤ ਮਾਡਲ ਡਾਊਨ ਹੋ ਗਿਆ ਤੁਸੀਂ ਉੱਪਰ ਓਹ ਮਾੜੀ ਮੋਟੀ ਰੇਂਜ ਦੱਸੋ ਹੋਰ ਕੋਈ ਦਿੱਲੀ ਨੰਬਰ ਮਿਲਜੂਗੀ ਜੀ ਥੋੜਾ ਲੱਭਣੇ ਪਊਗੀ ਮਿਲਜੂਗੀ ਸਾਰੀ ਚੀਜ਼ ਮਿਲਜੂਗੀ ਔਟੋਮੈਟਿਕ ਨਹੀਂ ਕਰਵਾਉਣੀ ਪਊਗੀ ਔਟੋਮੈਟਿਕ ਪਿੱਛੋਂ ਤੋਂ ਨਹੀਂ ਆਉਂਦੀ ਹੈ ਕਰਵਾਉਣੀ ਪਊਗੀ ਹਾਂ ਹਾਂਜੀ ਉਹ ਤਾਂ ਫਿਰ ਐਨ ਓ ਸੀ ਵਗੈਰਾ ਕਰਵਾ ਕੇ ਹੀ ਦੇਣੀ ਪੈਂਦੀ ਹੈ ਨਾ ਤੁਸੀਂ ਕਿੱਥੋਂ ਬੋਲਦੇ ਹੋ ਨਾ ਕਿਹੜੀ ਸਟੇਟ 'ਚ ਲੈ ਕੇ ਜਾਣੀ ਹੈ ਹਾਂਜੀ ਹਾਂਜੀ ਹਾਂਜੀ ਉਹ ਤਾਂ ਐਨ ਓ ਸੀ ਵਗੈਰਾ ਲੇ ਕੇ ਸਾਰਾ ਕੁੱਝ ਹੋ ਜਾਂਦਾ ਹਾਂਜੀ ਹਾਂਜੀ ਅਸੀਂ ਕਰਵਾ ਕੇ ਦਿੰਨੇ ਆ ਨਾ ਕਿਉਂ ਹੁਣ ਮਾਲਕਾਂ ਦੀ ਅੱਗੇ ਅੱਗੇ ਡਿਮਾਂਡ ਆਉਂਦੀ ਆਂ ਪਹਿਲਾਂ ਕਿਉਂ ਡੀਲਰ ਲੈ ਜਾਂਦੇ ਅਤੇ ਗੱਡੀ ਗੱਡੀਆਂ ਪੁਰਾਣੇ ਨਾਮ ਪਰ ਚੱਲੀ ਜਾਂਦੀ ਤੀਆਂ ਹੁਣ ਜਿਹੜੇ ਪੁਰਾਣੇ ਲੋਕ ਬੰਦੇ ਆ ਉਹ ਕਹਿੰਦੇ ਵੀ ਸਾਡੇ ਤੋਂ ਉੱਤੇ ਕੇਸ ਮਤਲਬ ਪੈ ਜਾਨੇ ਆ ਬੰਦਾ ਨਾਮ ਨਹੀਂ ਕਰਾਉਂਦੇ ਇਸ ਕਰਕੇ ਅਸੀਂ ਨਾਮ ਈ ਕਰਵਾ ਕੇ ਅੱਗੇ ਦਿੰਦੇ ਐ ਗੱਡੀ ਬਾ ਕੋਈ ਨੀ ਉਹ ਤਾਂ ਫਿਰ ਪੈਸਾ ਜੇ ਸ਼ੌਂਕ ਨਾਲ ਚੀਜ਼ ਲੇਣੀ ਫਿਰ ਤਾਂ ਪੈਸਾ ਲਾਉਣਾ ਹੀ ਪੈਣਾ ਹਾਂ ਹਾਂ ਨਾ ਫਿਰ ਤੁਹਾਨੂੰ ਮੌਡੀਫਾਈ ਕਰਵਾਉਣੀ ਪੈਣੀ ਏ ਚੰਗੇ ਤਰੀਕੇ ਨਾਲ਼ ਨਾ ਜਾਂ ਤਾਂ ਫਿਰ ਅਸੀਂ ਅਸੀਂ ਫਿਰ ਕਰਵਾ ਕੇ ਦੇਵਾਂਗੇ ਸਾਡੀ ਫਿਰ ਰੇਂਜ ਵਧੂਗੀ ਠੀਕ ਹੈ ਠੀਕ ਹੈ ਕੋਈ ਨੀ ਜੀ ਲੱਭ ਦਿਆਂਗੇ ਠੀਕ ਹੈ ਠੀਕ ਹੈ